ਸਾਡੇ ਪਿੰਡਾਂ ਵਿੱਚ ਬਹੁਤ ਅਜਿਹੇ ਕਾਰਨ ਹਨ ਜਿਨ੍ਹਾਂ ਕਾਰਨ ਸਾਡੇ ਪਿੰਡਾਂ ਦੇ ਬਜ਼ੁਰਗ ਮੰਜੇ 'ਤੇ ਪੈ ਜਾਂਦੇ ਹਨ ਉਹਨਾਂ ਵਿੱਚ ਸਭ ਤੋਂ ਮੁੱਖ ਕਾਰਨ ਵੱਧਦੀ ਉਮਰ ਦਾ ਹੈ ਉਮਰ ਵਧਣ ਦੇ ਨਾਲ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਉਹ ਚੱਲ ਫਿਰ ਨਹੀਂ ਸਕਦੇ ਇਹਨਾਂ ਤੋਂ ਬਿਨਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਦਿਲ ਦੇ ਰੋਗ ਹੱਡੀਆਂ ਦੇ ਰੋਗ ਗਡੀਏ ਦੇ ਰੋਗ ਖੂਨ ਵਿੱਚ ਚਰਬੀ ਦਾ ਵਧਣਾ ਅਤੇ ਅਧਰੰਗ ਵਰਗੇ ਭਿਆਨਕ ਰੋਗ ਸ਼ਾਮਿਲ ਹਨ ਇਹਨਾਂ ਰੋਗਾਂ ਕਾਰਨ ਉਹ ਮੰਜੇ 'ਤੇ ਪੈ ਜਾਂਦੇ ਹਨ ਇਸ ਤੋਂ ਬਿਨਾਂ ਗਰੀਬੀ ਵੀ ਇੱਕ ਮੁੱਖ ਕਾਰਨ ਹੋ ਸਕਦੀ ਹੈ ਗਰੀਬ ਬੰਦਾ ਆਪਣੀ ਸਿਹਤ ਮੁਤਾਬਕ ਚੰਗਾ ਖਾਣਾ ਪੀਣਾ ਨਹੀਂ ਖਾ ਸਕਦਾ ਅਤੇ ਪਰੇਸ਼ਾਨ ਰਹਿਣ ਲੱਗ ਜਾਂਦਾ ਹੈ ਇਹੀ ਮੁੱਖ ਕਾਰਨ ਹਨ ਸਾਡੇ ਬਜ਼ੁਰਗਾਂ ਦੇ ਮੰਜੇ 'ਤੇ ਪੈਣ ਦੇ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਸਾਡੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਚੰਗੀ ਦੇਖ ਭਾਲ ਕੀਤੀ ਜਾਂਦੀ ਹੈ ਜਿਵੇਂ ਕਿ ਸਮੇਂ ਸਿਰ ਉਨ੍ਹਾਂ ਨੂੰ ਭੋਜਨ ਦੇਣਾ ਉਨ੍ਹਾਂ ਦੇ ਕੱਪੜੇ ਬਦਲਨੇ ਉਹਨਾਂ ਨੂੰ ਇਸ਼ਨਾਨ ਆਦਿ ਕਰਾਉਣਾ ਅਤੇ ਡਾਕਟਰ ਦੇ ਦੱਸੇ ਮੁਤਾਬਕ ਉਹਨਾਂ ਨੂੰ ਦਵਾਈਆਂ ਬੂਟੀਆਂ ਦੇਣੀਆਂ ਧੰਨਵਾਦ